ਹੈਲੋ ਹਾਂਜੀ ਹਾਂਜੀ ਮੈਮ

ਅੱਛਾ ਜੀ ਫਤਿਹਗੜ੍ਹ ਸਾਹਿਬ 'ਚ ਅੱਛਾ ਜੀ ਅੱਛਾ ਮੈਮ ਅੱਛਾ ਤੁਸੀਂ ਯੂਟਿਊਬ ਚੈਨਲ 'ਤੇ ਵੀਡੀਓਜ਼ ਵਗੈਰਾ ਬਣਾਉਣੀ ਹੋਣੀ ਹਾਂਜੀ ਮੈਮ ਇੱਥੇ ਮ ਫਤਿਹਗੜ੍ਹ ਸਾਹਿਬ ਦੇ ਵਿੱਚ ਕਾਫ਼ੀ ਲੋਕੇਸ਼ਨਸ ਨੇ ਵੈਸੇ ਖਾਣ ਵਾਲੀਆਂ ਪਰ ਹੈ ਨਾ ਸਭ ਤੋਂ ਵੱਧ ਵਰਾਇਟੀ ਤੁਹਾਨੂੰ ਇੱਥੇ ਆਪਣਾ ਜੋਤੀ ਸਰੂਪ ਮੋੜਾਂ ਕੋਲ ਮਿਲੇਗੀ ਹਾਂਜੀ ਕਿਉਂਕਿ ਮੈਮ ਇੱਥੇ ਕਾਫ਼ੀ ਸਾਰੀ ਸ਼ੋਪਸ ਨੇ ਕਾਫ਼ੀ ਸਾਰੀ ਲੋਕਲ ਜਿਵੇਂ ਰੇਹੜੀਆਂ ਵਗੈਰਾ ਲੱਗਦੀਆਂ ਨੇ ਫੂਡ ਜੰਕ ਫੂਡ ਦੀਆਂ ਇੱਥੇ ਕਾਫ਼ੀ ਸਾਰੇ ਹੋਟਲ ਵਗੈਰਾ ਵੀ ਨੇ ਢਾਬੇ ਵੀ ਨੇ ਸਾਰਾ ਮਤਲਬ ਕੀ ਕਾਫ਼ੀ ਜ਼ਿਆਦਾ ਦੁਕਾਨ ਇੱਥੇ ਮੋੜਾਂ 'ਤੇ ਹੈਗੀਆਂ ਨੇ ਹਾਂਜੀ ਹਾਂਜੀ ਮੈਮ ਜਿਵੇਂ ਇੱਥੇ ਇੱਕ ਮਤਲਬ ਕਿ ਆਪਣਾ ਫੇਮਸ ਹੈ ਫੁਰਸਤ ਢਾਬਾ ਇਹਦੇ ਵਿੱਚ ਮਤਲਬ ਕਿ ਇਹ ਕੀ ਕਰਦੇ ਨੇ ਆਪਣਾ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਇੱਥੇ ਔਫਰਸ ਰੱਖਦੇ ਨੇ ਇਹ ਕਿ ਜਿਵੇਂ ਤੁਸੀਂ ਜੇ ਸਵੇਰ ਦੇ ਤੁਸੀਂ ਬ੍ਰੇਕਫਾਸਟ ਕਰਨਾ ਤਾਂ ਅੱਸੀ ਰੁਪਏ ਦੇ ਵਿੱਚ ਤੁਸੀਂ ਜਿੰਨੀ ਮਰਜ਼ੀ ਪਰੌਂਠੇ ਖਾ ਸਕਦੇ ਹੋ ਅਤੇ ਉਹਦੇ ਵਿੱਚ ਵੀ ਪਰੌਂਠੇ ਜਿਵੇਂ ਗੋਭੀ ਦੇ ਪਰੌਂਠੇ ਹੋ ਗਏ ਆਲੂ ਦੇ ਪਰੌਂਠੇ ਹੋ ਗਏ ਮੂਲੀ ਦੇ ਪਰੌਂਠੇ ਹੋ ਗਏ ਮਤਲਬ ਕਿ ਕਾਫ਼ੀ ਜ਼ਿਆਦਾ ਵਰਾਇਟੀ ਮਿਲਦੀ ਆ ਹਾਂਜੀ ਅਤੇ ਜੇ ਲੰਚ ਵਗੈਰਾ ਡਿਨਰ ਲੰਚ ਡਿਨਰ ਕਰਨਾ ਹੋਵੇ ਉਹ ਵੀ ਤੁਹਾਨੂੰ ਮਤਲਬ ਕਿ ਇੱਕ ਸੌ ਦਸ ਰੁਪਏ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਅਨਲਿਮਿਟਿਡ ਉੱਥੇ ਫੂਡ ਖਾ ਸਕਦੇ ਹੋ ਆਪਣਾ ਹਾਂਜੀ ਮੈਮ ਅਤੇ ਮਨਚੂਰੀਅਨ ਹਾਂਜੀ ਮੈਮ ਮਨਚੂਰੀਅਨ ਵੀ ਇੱਥੇ ਮਿਲ ਜਾਣਗੇ ਫੁਰਸਤ ਢਾਬੇ ਦੇ ਵਿੱਚ ਬਾਕੀ ਇੱਥੇ ਰਾਜਨ ਫਾਸਟ ਫੂਡ ਹੈ ਆਪਣਾ ਸਟੂਡੈਂਟ ਕੌਰਨਰ ਹੈ ਇੱਕ ਹੋਰ ਦੁਕਾਨ ਹੈ ਦੀਪਕ ਸਵੀਟਸ ਇੱਥੇ ਮਤਲਬ ਕਿ ਅਲੱਗ ਅਲੱਗ ਜੇ ਤੁਸੀਂ ਮਿੱਠਾ ਖਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੀਪਕ ਸਵੀਟ ਦੇ ਵਿੱਚ ਸਾਰਾ ਕੁਛ ਮਿਲ ਜੇਗਾ ਜਿਵੇਂ ਆਪਣਾ ਗੁਲਾਬ ਜਾਮੁਨ ਹੋ ਗਏ ਰਸਗੁੱਲੇ ਰਸਮਲਾਈ ਦਹੀਂ ਭੱਲੇ ਚਾਟ ਵਗੈਰਾ ਕੁਛ ਵੀ ਖਾਣਾ ਤਾਂ ਉਹ ਵੀ ਮਿਲ ਜੇਗਾ ਅਤੇ ਬਾਕੀ ਜੇ ਤੁਸੀਂ ਮਤਲਬ ਕਿ ਆਪਣਾ ਮਿਕਸ ਖਾਣਾ ਚਾਹੁੰਦੇ ਜਿਵੇਂ ਸਮੋਸੇ ਸਮੋਸੇ ਵਗੈਰਾ ਤਾਂ ਤੁਹਾਨੂੰ ਇਹ ਸਟੂਡੈਂਟ ਕੌਰਨਰ ਦੇ ਵਿੱਚ ਸਭ ਤੋਂ ਵਧੀਆ ਸਮੋਸੇ ਬਣਦੇ ਨੇ ਉੱਥੇ ਮਿਲ ਜੇਗਾ ਅਤੇ ਇੱਥੇ ਮੈਮ ਲੋਕ ਰੇਹੜੀਆਂ ਵਗੈਰਾ ਵੀ ਲਾਉਂਦੇ ਨੇ ਅਤੇ ਜਿਵੇਂ ਇੱਥੇ ਇੱਕ ਫੇਮਸ ਰੇਹੜੀ ਹੈਗੀ ਆਪਣੇ ਬਰਗਰ ਵਗੈਰਾ ਦੀ ਉਹ ਹੈਗੀ ਆ ਚੰਡੀਗੜ੍ਹ ਚਾਟ ਭੰਡਾਰ ਅਤੇ ਇਹ ਮਤਲਬ ਕਿ ਇਹਨਾਂ ਦੇ ਇਹ ਦਿੰਦੇ ਨੇ ਇਹ ਫਾਇਦਾ ਕਿ ਜਿਵੇਂ ਜੇ ਕਿਸੇ ਨੇ ਆਪਣਾ ਬਰਗਰ ਦੇ ਵਿੱਚ ਨਿਊਡਲ ਵਗੈਰਾ ਨਹੀਂ ਪਵਾਉਣਾ ਹੁੰਦਾ ਤਾਂ ਉਹ ਉਹਨਾਂ ਨੂੰ ਡਬਲ ਟਿੱਕੀ ਪਾ ਕੇ ਦੇ ਦਿੰਦੇ ਨੇ ਹਾਂਜੀ ਹਾਂਜੀ ਜੇ ਜਿਵੇਂ ਤੁਸੀਂ ਵੀਡੀਓ ਵਗੈਰਾ ਬਣਾਉਣੀ ਹੈ ਨਾ ਤਾਂ ਤੁਸੀਂ ਇਹਨਾਂ ਦੀ ਵੀ ਬਣਾ ਸਕਦੇ ਹੋ ਜਿਵੇਂ ਤੁਸੀਂ ਚਾਹੋਗੇ ਇਹ ਉਵੇਂ ਦਾ ਹੀ ਤੁਹਾਨੂੰ ਬਰਗਰ ਬਣਾ ਕੇ ਦੇਣਗੇ ਅਤੇ ਵੱਧ ਪੈਸੇ ਨਹੀਂ ਲੈਣਗੇ ਕੋਈ ਹਾਂਜੀ ਅਤੇ ਨਾਲ ਇਹਨਾਂ ਦੇ ਗੋਲ ਗੱਪਿਆਂ ਦੀ ਵੀ ਰੇਹੜੀ ਆ ਨਾਲ ਆਪਣਾ ਆਪਣਾ ਸਪਰਿੰਗ ਰੋਲ ਹੋ ਗਏ ਫਰੈਂਚ ਫਰਾਈਜ ਹੋ ਗਏ ਮੋਮੋਜ ਹੋ ਗਏ ਸਾਰਾ ਕੁਛ ਇਹਨਾਂ ਦੇ ਕੋਲ ਤੁਹਾਨੂੰ ਮਿਲ ਜੇਗਾ ਹਾਂਜੀ ਜੇ ਤੁਸੀਂ ਮਤਲਬ ਕਿ ਅਲੱਗ ਅਲੱਗ ਵਰਾਇਟੀ ਲੈਣੀ ਆ ਨਾ ਤੁਹਾਨੂੰ ਇੱਥੇ ਮੋੜਾਂ ਦੇ ਉੱਤੇ ਸਾਰੀ ਦੁਕਾਨਾਂ ਮਿਲ ਜਾਣੀਆਂ ਮਿੱਠੇ ਦੀਆਂ ਫਾਸਟ ਫੂਡ ਦੀਆਂ ਸਬਜ਼ੀ ਦੀ ਰਾਜਮਾਂਹ ਚੌਲ ਹੋ ਗਏ ਕੁਛ ਵੀ ਹੁੰਦਾ ਤੁਹਾਨੂੰ ਇਸ ਇੱਕ ਜਗ੍ਹਾ 'ਤੇ ਸਾਰਾ ਕੁਛ ਮਿਲ ਜੇਗਾ ਹਾਂਜੀ ਹਾਂਜੀ ਜੇ ਤੁਸੀਂ ਮਤਲਬ ਕਿ ਆਉਣਾ ਹੋਇਆ ਫਤਿਹਗੜ੍ਹ ਸਾਹਿਬ ਤਾਂ ਇੱਥੇ ਜ਼ਰੂ ਇੱਥੇ ਆਇਓ ਕਿਉਂਕਿ ਤੁਹਾਨੂੰ ਇੱਥੇ ਸਾਰੀ ਸ਼ੋਪਸ ਵਗੈਰਾ ਆਰਾਮ ਨਾਲ ਅਵੇਲੇਬਲ ਹੋ ਜਾਣਗੀਆਂ ਹਾਂਜੀ ਹਾਂਜੀ

ਓਕੇ ਜੀ